ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਰ ਜੀ ਵੀਜ਼ਾ ਆਈਲੈਟਸ ਸੈਂਟਰ ਤੋਂ ਬੋਲਦੇ ਹੋ ਅੱਛਾ ਸਰ ਆਪਾਂ ਫ਼ੀਸ ਕਿੰਨੀ ਲੈਂਦੇ ਹੈਂ ਜੀ ਅਸੀਂ ਮੈਂ ਆਈਲੈਟਸ ਕਰਨੀ ਸੀ ਹਾਂਜੀ ਜੀ ਆਪਾਂ ਫ਼ੀਸ ਕਿੰਨੀ ਲੈਂਦੇ ਹਾਂ ਅੱਛਾ ਜੀ ਆਪਣਾ ਆਈਲੈਟਸ ਸੈਂਟਰ ਆਪਣਾ ਕਿੱਥੇ ਹੈ ਜੀ ਆਪਣਾ ਕੁਰਾਲੀ ਅੱਛਾ ਜੀ ਚੰਡੀਗੜ੍ਹ ਹੈ ਜੀ ਠੀਕ ਹੈ ਮੈਂ ਇੱਕ ਕੁਰਾਲੀ ਵੀ ਸੀ ਵੀਜ਼ੇ ਵਾਲਾ ਚੰਡੀਗੜ੍ਹ ਕਿਹੜੇ ਸੈਕਟਰ ਵੀਰੇ ਅੱਛਾ ਠੀਕ ਹੈ ਜੀ ਠੀਕ ਹੈ ਅਤੇ ਆਪਾਂ ਮਤਲਬ ਤੁਹਾਡੀ ਗਰੰਟੀ ਹੈ ਜੀ ਬੈਂਡ ਬੂੰਡ ਆਉੂਂਗੇ ਅੱਛਾ ਜੀ ਅਤੇ ਟਾਈਮ ਟੂਮ ਕਿੰਨਾ ਲਗਵਾਉਂਦੇ ਹੈਂ ਜੀ ਮਤਲਬ ਦਿਨ 'ਚ

ਅੱਛਾ ਜੀ ਨਾ ਜੀ ਦਿਨ 'ਚ ਦਿਨ 'ਚ ਕਿੰਨਾ ਟਾਈਮ ਲਗਵਾਉਂਦੇ ਹੈ ਜੀ ਵੀ ਕਿੰਨੇ ਤੋਂ ਕਿੰਨੇ ਹੈ ਅੱਛਾ ਠੀਕ ਹੈ ਜੀ ਛੇ ਤੋਂ ਦੋ ਤੱਕ ਮਤਲਬ ਉਂਝ ਤੁਸੀਂ ਦੋ ਮਹੀਨੇ ਦਾ ਲਗਵਾਉਂਦੇ ਹੈ ਕੋਰਸ ਮਤਲਬ ਫਿਰ ਬੈਂਡ ਦੀ ਗਰੰਟੀ ਹੈ ਅੱਛਾ ਮਤਲਬ ਫਾਈਲ ਫੁਇਲ ਵੀ ਤੁਸੀਂ ਉਹ ਲਗਾ ਦਊਂਗੇ ਬਾਅਦ 'ਚ ਜਿਵੇਂ ਬੈਂਡ ਬੂੰਡ ਆ ਗਏ ਜੀ ਅੱਛਾ ਠੀਕ ਹੈ ਠੀਕ ਵੀਰੇ ਆਪਾਂ ਫਿਰ ਕੱਲ੍ਹ ਨੂੰ ਵੀਜ਼ਟ ਕਰਦੇ ਹਾਂ ਹਾਂਜੀ ਠੀਕ ਹੈ ਵੀਰੇ ਧੰਨਵਾਦ